ਆਮ ਤੌਰ 'ਤੇ ਅਸੀਂ ਦੁਪਹਿਰ ਦੇ ਖਾਣੇ ਵਿੱਚ ਕਹਿ ਲਓ ਕਿ ਹਲਕਾ ਫੁਲਕਾ ਹੀ ਬਣਾਉਦੇ ਹਾਂ ਦੁਪਹਿਰ ਦਾ ਇਹ ਹੁੰਦਾ ਕਿ ਸਵੇਰੇ ਸਭ ਨੇ ਆਪਣੇ ਆਪਣੇ ਕੰਮਾਂ 'ਤੇ ਜਾਣਾ ਹੁੰਦਾ ਦੁਪਹਿਰ ਦਾ ਕੋਈ ਐਨੀ ਖੇਚੀ ਨਹੀਂ ਰਹਿੰਦੀ ਹੈ ਇਸ ਕਰਕੇ ਜੋ ਸਵੇਰੇ ਫਟਾਫਟ ਬਣ ਜਾਵੇ ਬਸ ਉਹ ਹੀ ਬਣ ਜਾਂਦਾ ਜਿਸ ਤਰ੍ਹਾਂ ਕਹਿ ਲਓ ਕਿ ਦੁਪਹਿਰ ਦੇ ਸਮੇਂ ਅਸੀਂ ਕੋਈ ਦਾਲ ਕੋਈ ਸੁੱਕੀ ਸਬਜ਼ੀ ਨਾਲ ਰਾਇਤਾ ਕੋਈ ਵੀ ਕਹਿ ਲਓ ਮਿਕਸ ਪੁਲਾਓ ਇਹੋ ਜਿਹੀਆਂ ਚੀਜ਼ਾਂ ਬਣਾ ਲੈਂਦੇ ਹਾਂ ਲੇਕਿਨ ਰਾਤ ਦਾ ਖਾਣਾ ਥੋੜ੍ਹਾ ਸਪੈਸ਼ਲ ਹੋ ਜਾਂਦਾ ਕਿਉਂਕਿ ਸਾਰੇ ਦਿਨ ਰਾਤ ਨੂੰ ਬੱਚੇ ਅਸੀਂ ਮੈਂ ਮੇਰੇ ਹਸਬੈਂਡ ਮਦਰਇਨਲੋ ਸਾਰੇ ਇਕੱਠੇ ਹੁੰਦੇ ਹਾਂ ਹਸਬੈਂਡ ਸਵੇਰ ਦੇ ਗਏ ਰਾਤੀ ਆਉਂਦੇ ਆ ਉਹਨਾਂ ਨੂੰ ਇਹ ਚੀਜ਼ ਹੁੰਦੀ ਹੈ ਕਿ ਆਏ ਹਾਂ ਅਤੇ ਕੁਛ ਸਪੈਸ਼ਲ ਹੋਏ ਬੱਚੇ ਵੀ ਸਵੇਰੇ ਟਿਫਨ 'ਚ ਖਾ ਕੇ ਬੋਰ ਹੋਏ ਹੁੰਦੇ ਆ ਦੁਪਹਿਰ ਦਾ ਖਾਣਾ ਇਸ ਕਰਕੇ ਰਾਤ ਨੂੰ ਇਹ ਹੁੰਦਾ ਕਿ ਕੁਛ ਸਪੈਸ਼ਲ ਸਾਡੇ ਘਰ ਜਿਸ ਤਰ੍ਹਾਂ ਕਹਿ ਲਓ ਪਾਓ ਭਾਜੀ ਇਡਲੀ ਡੋਸਾ ਰਾ ਮਤਲਬ ਰਾਜਮਾਂਹ ਕੜ੍ਹੀ ਇਹ ਸਭ ਚੀਜ਼ਾਂ ਰਾਤ ਨੂੰ ਹੀ ਬਣਦੀਆਂ ਨੇ ਕਿਉਂਕਿ ਦੁਪਹਿਰ ਨੂੰ ਹਸਬੈਂਡ ਵੀ ਟਿਫਨ ਲੈ ਕੇ ਜਾਂਦੇ ਹੈ ਬੱਚੇ ਵੀ ਟਿਫਨ ਲੈ ਕੇ ਜਾਂਦੇ ਹੈ ਸਵੇਰੇ ਮੈਂ ਵੀ ਦਫ਼ਤਰ ਜਾਣਾ ਹੁੰਦਾ ਤਾਂ ਇੰਨਾ ਜਲਦੀ ਜਲਦੀ ਕੁਛ ਵਧੀਆ ਬਣ ਨਹੀਂ ਪਾਉਂਦਾ ਸਿਰਫ ਇਹ ਕਿ ਦਾਲ ਚਾਵਲ ਸੁੱਕੀ ਸਬਜ਼ੀ ਇਸ ਤਰ੍ਹਾਂ ਰੋਜ਼ ਕਰ ਕਰਕੇ ਆ ਵੱਖੋ ਵੱਖ ਅਸੀਂ ਉਹ ਹੀ ਬਣਾ ਲੈਂਦੇ ਹਾਂ ਲੇਕਿਨ ਰਾਤ ਨੂੰ ਹੁੰਦਾ ਆ ਕਿ ਸਾਰੇ ਇਕੱਠੇ ਹੋਏ ਹਾਂ ਅਤੇ ਪਿਆਰ ਨਾਲ ਕੁਛ ਇਹੋ ਜਿਹਾ ਬਣਾਈਏ ਸਪੈਸ਼ਲ ਕਿ ਕੁਛ ਯਾਦ ਰਹੇ ਮੇਰੇ ਘਰ ਦੇ ਵਿੱਚ ਮੇਰੇ ਬੱਚਿਆਂ ਨੂੰ ਪਾਓ ਭਾਜੀ ਬਹੁਤ ਪਸੰਦ ਹੈ ਜਿਸ ਤਰ੍ਹਾਂ ਸਾਂਬਰ ਬਣਾਈ ਤਾਂ ਉਹਨਾਂ ਨੇ ਕਹਿਣਾ ਹੈ ਕਿ ਮੰਮਾ ਇਹਦੇ ਨਾਲ ਤੁਸੀਂ ਇਡਲੀ ਬਣਾਓ ਉਹਨਾਂ ਨੂੰ ਬਹੁਤ ਪਸੰਦ ਆਉਂਦੀਆਂ ਇਹ ਸਭ ਚੀਜ਼ਾਂ ਇਸ ਕਰਕੇ ਜੋ ਕੁਛ ਵੀ ਹੈ ਇੱਕ ਰਾਤ ਨੂੰ ਮੇਰੇ ਕੋਲ ਖੁੱਲਾ ਸਮਾਂ ਵੀ ਹੁੰਦਾ ਕੋਈ ਦਫ਼ਤਰ ਜਾਣ ਦੀ ਕੋਈ ਟਿਫਨ ਤਿਆਰ ਕਰਨ ਦੀ ਬੱਚਿਆਂ ਦਾ ਕਿਸੇ ਕਿਸਮ ਦੀ ਕੋਈ ਖਿੱਚ ਨਹੀਂ ਹੁੰਦੀ ਇਸ ਕਰਕੇ ਇਹ ਹੀ ਹੁੰਦਾ ਕਿ ਰਾਤ ਦਾ ਖਾਣਾ ਕੁਛ ਸਪੈਸ਼ਲ ਬਣਾ ਲਈਏ